ਬਰਤਨਾਂ ਤੋਂ ਬਿਨਾਂ ਰਸੋਈ ਹਮੇਸ਼ਾਂ ਅਧੂਰੀ ਹੁੰਦੀ ਆ ਜਿਵੇਂ ਹੁਣ ਬਰਤਨਾਂ ਦੀ ਗੱਲ ਕਰੀਏ ਤਾਂ ਆਪਣਾ ਬਣਾਉਣ 'ਚ ਜਿਵੇਂ ਆ ਜਾਂਦੇ ਆ ਕੁੱਕਰ ਹੋ ਗਿਆ ਅਤੇ ਕੜਾਹੀ ਹੋ ਗਈ ਇਹਨਾਂ 'ਚ ਜਿਵੇਂ ਵੱਖ ਵੱਖ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਜੀ ਅਤੇ ਆਪਣਾ ਪਰਾਤ ਹੋ ਗਈ ਪਰਾਤ 'ਚ ਆਟਾ ਗੁੰਨ ਕੇ ਸਾਰਾ ਉਹਦੇ 'ਚੋਂ ਬਾਅਦ ਫਿਰ ਪਕਾਇਆ ਜਾਂਦਾ ਏ ਅਤੇ ਥਾਲ ਹੋ ਗਿਆ ਥਾਲ 'ਚ ਰੋਟੀ ਪਰੋਸਣ ਦਾ ਕੰਮ ਹੁੰਦਾ ਕੌਲੀ ਹੁੰਦੀ ਆ ਕੌਲੀ 'ਚ ਆਪਣਾ ਸਬਜ਼ੀਆਂ ਪਾ ਲੈਂਦੇ ਹਾਂ ਅਤੇ ਚਮਚਾ ਹੋ ਗਿਆ ਅਤੇ ਆਪਣਾ ਗਲਾਸ ਹੋ ਗਿਆ ਗਲਾਸ 'ਚ ਆਪਣਾ ਪਾਣੀ ਵੀ ਪੀ ਲੈਂਦੇ ਹਾਂ ਅਤੇ ਚਾਹ ਵੀ ਪੀਤੀ ਜਾਂਦੀ ਆ ਅਤੇ ਬਾਕੀ ਜਿਵੇਂ ਫਰਾਈ ਪੇਨ ਹੋ ਗਿਆ ਇਹਦੇ 'ਚ ਆਮਲੇਟ ਵਗੈਰਾ ਵੀ ਕਈ ਪਿੰਡਾਂ ਚ ਬਣਾ ਲੈਂਦੇ ਆ ਅਤੇ ਕਈ ਘਰਾਂ 'ਚ ਨਹੀਂ ਵੀ ਬਣਦਾ ਏ ਆਮਲੇਟ ਅਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਅਤੇ ਇਹਨਾਂ ਤੋਂ ਬਿਨਾਂ ਰਸੋਈ ਰਸੋਈ ਨਹੀਂ ਹੁੰਦੀ ਬਰਤਨਾਂ ਤੋਂ ਬਿਨਾਂ